ਜਿੱਦਾਂ ਕਿ ਅੱਜ ਦੇ ਟਾਈਮ ਦੇ ਵਿੱਚ ਇੰਟਰਨੈਟ ਸਾਰਿਆਂ ਲਈ ਜ਼ਰੂਰੀ ਆ ਆਪਾਂ ਵੇਖ ਸਕਦੇ ਹਾਂ ਕਿ ਅੱਜ ਤਾਂ ਛੋਟੇ ਤੋਂ ਛੋਟੇ ਅਤੇ ਵੱਡੇ ਤੋਂ ਵੱਡੇ ਬਜ਼ੁਰਗਾਂ ਤੱਕ ਇੰਟਰਨੈਟ ਦੀ ਸੁਵਿਧਾ ਸਾਰਿਆਂ ਨੂੰ ਚਾਹੀਦੀ ਆ ਇਸ ਤਰ੍ਹਾਂ ਹੀ ਅਸੀਂ ਆਪਣੇ ਘਰ ਦੇ ਵਿੱਚ ਲੈਡਲਾਈਨ ਇੰਟਰਨੈਟ ਕਨੈਕਸ਼ਨ ਲਗਵਾਇਆ ਸੀਗਾ ਬਟ ਹਾਂ ਅਸੀਂ ਕੁਨੈਕਸ਼ਨ ਜਦੋਂ ਲਗਵਾਇਆ ਤਾਂ ਇਹ ਸਾਨੂੰ ਚੰਗੀ ਤਰ੍ਹਾਂ ਇੰਟਰਨੈਟ ਸੇਵਾ ਪ੍ਰਦਾਨ ਨਹੀਂ ਕਰ ਰਿਹਾ ਅਤੇ ਸਾਡੇ ਇਹਦੇ ਵਿੱਚ ਮਤਲਬ ਰੁਕਾਵਟਾਂ ਆ ਰਹੀਆਂ ਨੇ ਸਾਨੂੰ ਪ੍ਰੋਪਰ ਸਾਡਾ ਇੰਟਰਨੈਟ ਅਸੀਂ ਸਾਰੇ ਜਣੇ ਕੰਮ ਕਰਨ ਵਾਲੇ ਹਾਂ ਸਾਡਾ ਸਾਰਾ ਕੰਮ ਆਨਲਾਈਨ ਹੀ ਹੈ ਜਿਸ 'ਤੇ ਅਸੀਂ ਜਿਸ ਕਰਕੇ ਸਾਨੂੰ ਇੰਟਰਨੈਟ ਦੀ ਬਹੁਤ ਜ਼ਿਆਦਾ ਜ਼ਰੂਰਤ ਪੈਂਦੀ ਹੈ ਬੱਚੇ ਵੀ ਇੰਟਰਨੈਟ 'ਤੇ ਕੰਮ ਕਰ ਰਹੇ ਨੇ ਅਤੇ ਸਾਰੇ ਵੀ ਵੱਡੇ ਵੀ ਸਾਰੇ ਇੰਟਰਨੈਟ 'ਤੇ ਕੰਮ ਕਰ ਰਹੇ ਹਨ ਅਤੇ ਸਾਡੀ ਜਿਹੜੀ ਇੰਟਰਨੈਟ ਦੀ ਰੇਂਜ ਆ ਬਹੁਤ ਘੱਟ ਆ ਰਹੀ ਹੈ ਸਾਨੂੰ ਕੰਮ ਕਰਨ ਦੇ ਵਿੱਚ ਦਿੱਕਤ ਆ ਰਹੀ ਹੈ ਕਿਉਂਕਿ ਅਸੀਂ ਆਲਮੋਸਟ ਸਾਰਾ ਕੰਮ ਹੀ ਸਾਡਾ ਵਰਕਿੰਗ ਦਾ ਸਾਰੇ ਸਾਡੇ ਵਰਕਿੰਗ ਫੈਮਲੀ ਮੈਂਬਰ ਨੇ ਤਾਂ ਜੋ ਕਿ ਅਸੀਂ ਇਹ ਚਾਹੁੰਦੇ ਹਾਂ ਕਿ ਸਾਡੀ ਜਿਹੜੀ ਇੰਟਰਨੈਟ ਦੀ ਸੇਵਾ ਕਿਰਪਾ ਕਰਕੇ ਪਲੀਜ਼ ਤੁਸੀਂ ਜਲਦੀ ਤੋਂ ਜਲਦੀ ਇਹਦਾ ਕੋਈ ਨਿਪਟਾਰਾ ਕਰੋ ਤਾਂ ਜੋ ਕਿ ਸਾਨੂੰ ਇੰਟਰਨੈਟ ਦੇ ਇੰਟਰਨੈਟ ਚਲਾਉਣ ਦੇ ਵਿੱਚ ਕੋਈ ਪ੍ਰੋਬਲਮ ਨਾ ਆਵੇ ਤਾਂ ਜੋ ਕਿ ਅਸੀਂ ਇਹਨਾਂ ਨੂੰ ਕੰਪਲੀਟ ਕ ਆਪਦਾ ਕੰਮ ਕੰਪਲੀਟ ਕਰ ਸਕੀਏ ਕਿਉਂਕਿ ਸਾਡੇ ਆਫਿਸ ਦੇ ਕੰਮ ਵੀ ਨੇ ਬੱਚਿਆਂ ਦੇ ਸਕੂਲ ਦੇ ਕੰਮ ਵੀ ਨੇ ਜਿਸ ਕਰਕੇ ਸਾਡੀਆਂ ਜਿਹੜੀਆਂ ਕੰਮ ਦੇ ਵਿੱਚ ਰੁਕਾਵਟਾਂ ਆ ਰਹੀਆਂ ਨੇ ਕਿਰਪਾ ਕਰਕੇ ਅਸੀਂ ਤੁਹਾਨੂੰ ਇਹੀ ਰਿਕੁਐਸਟ ਕਰਨਾ ਚਾਹੁੰਦੇ ਹਾਂ ਕਿ ਸਾਡਾ ਇੰਟਰਨੈਟ ਸੁਵਿਧਾ ਦਾ ਜਿਹੜਾ ਤੁਸੀਂ ਲੈਡਲਾਈਨ ਕੁਨੈਕਸ਼ਨ ਇੰਟਰਨੈਟ ਲਗ ਲਗਾ ਕੇ ਗਏ ਹੋ ਦੁਬਾਰਾ ਆ ਕੇ ਚੈੱਕ ਕਰ ਜਾਓ ਤਾਂ ਸਾਨੂੰ ਬਾਅਦ 'ਚੋਂ ਕੋਈ ਰੁਕਾਵਟ ਨਾ ਆਵੇ ਕੰਮ ਕਰਨ ਵੇਲੇ ਅਤੇ ਕ ਇਹਦੀ ਕਿਸੇ ਵੀ ਸੇਵਾ ਦੇ ਵਿੱਚ ਅਗਰ ਜੇ ਰੁਕਾਵਟ ਆਉਂਦੀ ਹੈ ਤਾਂ ਦੁਬਾਰਾ ਅਸੀਂ ਕੀ ਕਰ ਸਕਦੇ ਹਾਂ ਕਿਰਪਾ ਕਰਕੇ ਅਸੀਂ ਤੁਹਾਡੇ ਅੱਗੇ ਇਹੀ ਰਿਕੁਐਸਟ ਕਰ ਸਕਦੇ ਹਾਂ ਕਿ ਪਲੀਜ਼ ਤੁਸੀਂ ਸਾਡਾ ਇੱਕ ਵਾਰੀ ਆ ਕੇ ਇੰਟਰਨੈਟ ਕਨੈਕਸ਼ਨ ਚੈੱਕ ਕਰ ਜਾਓ ਅਤੇ ਸਾਨੂੰ ਦੱਸ ਜਾਓ ਕਿ ਇਸ ਦੇ ਵਿੱਚ ਕੀ ਰੁਕਾਵਟ ਹੈ ਤਾਂ ਇਹਨੂੰ ਠੀਕ ਕਰ ਜਾਓ ਕਿ ਪਲੀਜ਼ ਦੁਬਾਰਾ ਕਿ ਕੋਈ ਰੁਕਾਵਟ ਨਾ ਆਵੇ